ਬਾਜ਼ਾਰ ਨਾਲੋਂ ਬਣੇ ਕੱਪੜੇ ਹੱਥੀਂ ਕੱਪੜੇ ਤਾਂ ਬਹੁਤ ਹੀ ਵਧੀਆ ਅਤੇ ਫਿਟਿੰਗ 'ਚ ਸੀਤੇ ਜਾਂਦੇ ਨੇ ਅਤੇ ਰੇਡੀਮੇਡ ਕੱਪੜੇ ਦੀ ਮਾਰਕੀਟ 'ਚ ਵੀ ਚਲੇ ਜਾਈਏ ਫਿਰ ਵੀ ਲੋਕ ਬੁਣੇ ਹੋਏ ਕੱਪੜੇ ਇਸ ਲਈ ਕਰਕੇ ਲੈਂਦੇ ਹਨ ਕਿਉਂਕਿ ਉਸ ਦੀ ਬੁਣਾਈ ਅਤੇ ਉਸ ਦਾ ਮਤਲਬ ਕਿ ਪਿਛੋਕੜ ਅਤੇ ਮਤਲਬ ਕਿ ਸੱਭਿਆਚਾਰ ਨਾਲ਼ ਜੁੜੇ ਰਹਿਣ ਦਾ ਇੱਕ ਤਰੀਕਾ ਮੰਨਿਆ ਜਾਂਦਾ ਅਤੇ ਉਸ ਨੂੰ ਤਾਂ ਪਸੰਦ ਕਰਦੇ ਨੇ ਕਿਉਂਕਿ ਉਸਦੀ ਬੁਣਤੀ ਉਸਦੀ ਡਿਜ਼ਾਇਨ ਅਤੇ ਉਸਦਾ ਕੱਪੜਾ ਸਿੰਪਲ ਹੁੰਦਾ ਅਤੇ ਉਹ ਸਾਡੇ ਇਤਿਹਾਸ ਨਾਲ਼ ਸਾਨੂੰ ਜੁੜੇ ਰਹਿਣ ਲਈ ਜੋੜਦਾ ਪ੍ਰੇਰਿਤ ਕਰਦਾ ਅਤੇ ਉਸ ਬਾਰੇ ਸਾਨੂੰ ਸਿਖਾਉਂਦਾ ਰਹਿੰਦਾ ਹੈ ਅਤੇ ਰੇਡੀਮੇਡ ਕੱਪੜਿਆਂ ਨਾਲੋਂ ਕੱਪੜੇ ਘਰ ਦੇ ਬੁਣੇ ਹੋਏ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਮੈਂ ਵੀ ਜ਼ਿਆਦਾਤਰ ਹੱਥੀਂ ਕੱਪੜੇ ਬੁਣਿਆ ਹੋਇਆ ਨੂੰ ਪ੍ਰੈਫਰੈਂਸ ਜ਼ਿਆਦਾ ਦਿੰਦਾ ਅਤੇ ਮੈਨੂੰ ਵਧੀਆ ਲੱਗਦੇ ਹਨ